ਸ਼ਹਿਰੀ ਖੇਤਰ ਵਿੱਚ ਰਹਿਣ ਕਰਕੇ ਸਾਡੇ ਘਰ ਬਿਜਲੀ ਦੇ ਕੱਟ ਬਹੁਤ ਘੱਟ ਲੱਗਦੇ ਹਨ ਲਗਾਤਾਰ ਚੌਵੀ ਘੰਟੇ ਬਿਜਲੀ ਆਉਂਦੀ ਰਹਿੰਦੀ ਹੈ ਕਦੀ ਕਦੀ ਤਕਨੀਕੀ ਖ਼ਰਾਬੀ ਕਰਕੇ ਚਾਹੇ ਬਿਜਲੀ ਬੰਦ ਹੋ ਜਾਵੇ ਪਰ ਜ਼ਿਆਦਾਤਰ ਬਿਜਲੀ ਆਉਂਦੀ ਹੀ ਰਹਿੰਦੀ ਹੈ ਜਦੋਂ ਕਦੇ ਬਿਜਲੀ ਦਾ ਕੱਟ ਲੱਗਣਾ ਹੋਵੇ ਤਾਂ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ ਜਿਵੇਂ ਕਿ ਨਿਊਜ਼ ਪੇਪਰ ਵਿੱਚ ਬਿਜਲੀ ਮਹਿਕਮੇ ਦੁਆਰਾ ਕਢਵਾ ਦਿੱਤਾ ਜਾਂਦਾ ਹੈ ਕਿ ਅੱਜ ਬਿਜਲੀ ਬੰਦ ਰਹੇਗੀ ਜਾਂ ਅੱਜ ਬਿਜਲੀ ਦਾ ਕੱਟ ਹੈ ਤਾਂ ਜੋ ਲੋਕ ਪਹਿਲਾਂ ਹੀ ਆਪਣੇ ਘਰਾਂ ਵਿੱਚ ਪਾਣੀ ਭਰ ਸਕਣ ਅਤੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਾ ਹੋਵੇ ਜ਼ਿਆਦਾਤਰ ਹਨੇਰੀ ਮੀਂਹ ਜਾਂ ਕਣਕਾਂ ਦੀ ਕਟਾਈ ਦੇ ਦੌਰਾਨ ਹੀ ਬਿਜਲੀ ਦੇ ਕੱਟ ਲੱਗਦੇ ਹਨ ਜਦੋਂ ਵੀ ਕਣਕਾਂ ਦੀ ਕਟਾਈ ਹੁੰਦੀ ਹੈ ਤਾਂ ਬਿਜਲੀ ਦੇ ਕੱਟ ਕਾਫੀ ਲੱਗਦੇ ਹਨ ਗਰਮੀਆਂ ਵਿੱਚ ਬਿਜਲੀ ਦੇ ਕੱਟ ਕਾਫੀ ਲੱਗਦੇ ਹਨ ਅੱਜ ਕੱਲ੍ਹ ਘਰ ਘਰ ਵਿੱਚ ਏ ਸੀ ਲੱਗੇ ਹੋਏ ਹਨ ਬਿਜਲੀ ਦੇ ਕੱਟ ਲੱਗਣ ਕਾਰਨ ਲੋਕਾਂ ਦੇ ਏ ਸੀ ਨਹੀਂ ਚਲਦੇ ਗਰਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਪੱਖਿਆਂ ਥੱਲੇ ਵੀ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ ਗਰਮੀਆਂ ਵਿੱਚ ਮੱਛਰ ਵੀ ਬਹੁਤ ਹੁੰਦਾ ਹੈ ਅਤੇ ਬਿਜਲੀ ਦੇ ਕੱਟ ਲੱਗਣ ਨਾਲ ਨਾ ਤਾਂ ਪੱਖੇ ਚਲਦੇ ਹਨ ਅਤੇ ਨਾ ਹੀ ਏ ਸੀ ਚੱਲਦੇ ਹਨ ਅਤੇ ਮੱਛਰ ਵੀ ਲੋਕਾਂ ਨੂੰ ਆਰਾਮ ਨਹੀਂ ਕਰਨ ਦਿੰਦਾ ਰਾਤ ਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਲਾਈਟ ਵਗੈਰਾ ਚਲੀ ਜਾਂਦੀ ਹੈ ਅਤੇ ਗਰਮੀਆਂ ਵਿੱਚ ਫਰੀਜ਼ਰ ਵਗੈਰਾ ਵੀ ਬੰਦ ਹੋ ਜਾਂਦੇ ਹਨ ਅਤੇ ਫਰਿਜ ਵਿੱਚ ਪਿਆ ਸਮਾਨ ਵੀ ਖ਼ਰਾਬ ਹੋ ਜਾਂਦਾ ਹੈ ਜ਼ਿਆਦਾ ਦੇਰ ਤੱਕ ਜਦੋਂ ਬਿਜਲੀ ਦਾ ਕੱਟ ਲੱਗਦਾ ਹੈ ਤਾਂ ਹਾਂ ਫ੍ਰਿਜ ਵਿਚਲਾ ਪਿਆ ਸਾਰਾ ਹੀ ਸਮਾਨ ਜਿਹੜਾ ਹੈ ਉਹ ਖ਼ਰਾਬ ਹੋ ਜਾਂਦਾ ਹੈ ਅਤੇ ਜ਼ਿਆਦਾ ਦੇਰ ਤੱਕ ਬੱਤੀ ਜਾਣ ਕਰਕੇ ਕਈ ਵਾਰ ਤਾਂ ਇਨਵੇਟਰ ਵੀ ਬੰਦ ਹੋ ਜਾਂਦੇ ਹਨ ਕਈ ਘਰਾਂ ਵਿੱਚ ਤਾਂ ਇਨਵੇਟਰ ਵੀ ਨਹੀਂ ਹੁੰਦੇ ਗਰਮੀਆਂ ਵਿੱਚ ਬੱਤੀ ਜਾਣ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਸਰਦੀਆਂ ਵਿੱਚ ਵੀ ਜਦੋਂ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਹੀਟਰ ਨਹੀਂ ਚੱਲਦੇ ਜਿਹੜੇ ਲੋਕ ਇੰਡਕਸ਼ਨ ਚੁੱਲ੍ਹਿਆਂ 'ਤੇ ਕੰਮ ਕਰਦੇ ਹਨ ਉਹ ਨਹੀਂ ਚੱਲਦੀ ਟੀ ਵੀ ਨਹੀਂ ਚਲਦੇ ਗੀਜਰ ਨਹੀਂ ਚੱਲਦੇ ਮੌਸਮ ਚਾਹੇ ਕੋਈ ਵੀ ਹੋਵੇ ਬਿਜਲੀ ਦੇ ਕੱਟ ਸਾਡੇ ਜੀਵਨ ਨੂੰ ਹਰ ਮੌਸਮ ਵਿੱਚ ਹੀ ਪ੍ਰਭਾਵਿਤ ਕਰਦੇ ਹਨ ਧੰਨਵਾਦ